ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਕਿੱਥੋਂ ਸਵੀਗੀ ਤੋਂ ਗੱਲ ਕਰ ਰਹੇ ਹੋ ਐਕਚੁਲੀ ਵੀਰੇ ਮੈਂ ਨਾ ਹੁਣੇ ਅੋਰਡਰ ਕੀਤਾ ਸੀ ਚਾਈਨੀਜ਼ ਐਕਸਪ੍ਰੈਸ ਰੈਸਟੋਰੈਂਟ ਤੋਂ ਅੋਰਡਰ ਕੀਤਾ ਸੀ ਮੇਰਾ ਅੋਰਡਰ ਇੱਕ ਤਾਂ ਮੰਚੂਰਿਅਨ ਅਤੇ ਇੱਕ ਚੀਜ਼ ਚਿੱਲੀ ਹੈ ਉਹ ਮੇਥੋਂ ਆਪਣੇ ਨਾ ਅੋਫਿਸ ਵਾਲੇ ਐਡਰੈਸ 'ਤੇ ਪੈ ਗਿਆ ਮੇਰਾ ਅੋਫਿਸ ਦਾ ਐਡਰੈਸ ਨਾਮਦੇਵ ਮਾਰਗ ਆਪਣੇ ਗਲੀ ਨੰਬਰ ਇੱਕ ਬਠਿੰਡਾ ਵਿਖੇ ਹੈ ਅਤੇ ਪਰ ਮੈਂ ਇਸ ਟਾਈਮ ਘਰੇ ਹਾਂ ਅਤੇ ਮੈਂ ਚਾਹੁੰਦਾ ਵੀ ਤੁਸੀਂ ਉਹ ਅੋਰਡਰ ਮੇਰਾ ਮੇਰੇ ਘਰੇ ਪਹੁੰਚਾ ਦਿਓ ਅਤੇ ਮੇਰਾ ਘਰ ਦਾ ਐਡਰੈਸ ਹੈਗਾ ਉਹ ਹਾਊਸ ਨੰਬਰ ਉਹ ਨੋਟ ਕਰ ਲਓ ਤੁਸੀਂ ਉਹ ਹੈਗਾ ਹਾਊਸ ਨੰਬਰ ਏ ਉਣੰਜਾ ਕਰਤਾਰ ਕਲੋਨੀ ਓਪੋਜਿਟ ਲੀਕ ਨੰਬਰ ਥ੍ਰੀ ਬਠਿੰਡਾ ਅਤੇ ਇਹ ਅੋਰਡਰ ਨਾ ਮਤਲਬ ਠੰਡਾ ਨਾ ਹੋਵੇ ਮੈਂ ਚਾਹੁੰਦਾ ਵੀ ਠੰਡੇ ਹੋਣ ਤੋਂ ਜਾਂ ਲੇਟ ਨਾ ਕਰਿਓ ਇਹ ਅੋਰਡਰ ਮਤਲਬ ਪੰਦਰਾਂ ਤੋਂ ਵੀਹ ਮਿੰਟਾਂ ਦੇ ਵਿੱਚ ਪਹੁੰਚਾ ਦਿਓ ਅਤੇ ਜੇ ਤੁਹਾਨੂੰ ਇਹ ਦੂਰ ਲੱਗਦਾ ਹੋਇਆ ਪਹਿਲਾਂ ਵਾਲੇ ਐਡਰੈਸ ਤੋਂ ਤੁਹਾਨੂੰ ਜ਼ਿਆਦਾ ਪੈ ਰਿਹਾ ਕਿਲੋਮੀਟਰਸ ਹੈ ਨਾ ਉਹਦਾ ਕੋਈ ਮੈਂ ਐਕਸਟਰਾ ਖਰਚਾ ਤੁਹਾਨੂੰ ਮੌਕੇ 'ਤੇ ਦੇ ਦੂੰਗਾ ਅਤੇ ਬਾਕੀ ਆਪਣਾ ਅੋਰਡਰ ਹੈ ਸਾਰਾ ਕੈਸ਼ ਓਨ ਡਿਲੀਵਰੀ ਆ ਅਤੇ ਉਹਦੀ ਕੋਈ ਚਿੰਤਾ ਨਹੀਂ ਅਤੇ ਬਸ ਮੇਰਾ ਵੀਰ ਨਾ ਪੰਦਰਾਂ ਤੋਂ ਵੀਹ ਮਿੰਟਾਂ ਤੱਕ ਮੇਰੇ ਕੋਲੋ ਪਹੁੰਚਾ ਦਿਓ ਅੋਰਡਰ